ਹਾਂਜੀ ਹਾਂਜੀ ਹਾਂਜੀ ਆਪ ਕਿੱਥੋਂ ਬੋਲਦੇ ਹਾਂਜੀ ਹਾਂਜੀ ਦੱਸੋ ਜੀ ਅੱਛਾ ਹਾਂਜੀ ਆਪਣੇ ਕੋਲ ਐਡੀਡਾਸ ਹੈਗਾ ਗਾ ਜੀ ਨਾਇਕੀ ਦੇ ਮਿਲ ਜਾਣਗੇ ਤੁਹਾਨੂੰ ਹਾਂ ਪਿਊਮਾ ਵੀ ਹੈ ਰੈਡ ਟੇਪ ਵੀ ਰੱਖਦੇ ਹਾਂ ਜੀ ਔਫਰ ਸਰ ਅੱਡੋ ਅੱਡ ਹੈਗਾ ਹਰ ਇੱਕ ਬਰਾਂਡ ਦੇ ਵੱਖ ਵੱਖ ਆ ਵੈਸੇ ਫਿਫਟੀ ਚੱਲ ਰਿਹਾ ਹੈਗਾ ਮੋਸਟਲੀ ਅਗਰ ਟੂ ਪੇਅਰ ਲੈਂਦੇ ਹੋ ਤਾਂ ਹਾਂਜੀ ਹਾਂਜੀ ਸਿੰਗਲ ਦੇ ਉੱਪਰ ਟਵੈਂਟੀ ਹੈਗਾ ਜੀ

ਹਾਂਜੀ ਹਾਂਜੀ ਲੇਡੀਜ਼ ਦੇ ਵੀ ਹੈਗੇ ਜੀ ਆਪਣੇ ਕੋਲ ਹਾਂ ਹਾਂ ਉਹ ਲੈਦਰ ਦੇ ਵਿੱਚ ਕਾਫ਼ੀ ਪ੍ਰੀਮੀਅਮ ਕੁਆਲਿਟੀ ਹੈਗੀ ਆਪਣੇ ਕੋਲੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫੁੱਲ ਜੀ ਹਾਂਜ ਹੁੰਦਾ ਹੀ ਨਹੀਂ ਕੁਝ ਜੀ ਆ ਆਪਾਂ ਡੇਲੀ ਰੂਟੀਨ 'ਚ ਵਰਤੋ ਕੁਛ ਨਹੀਂ ਹੁੰਦਾ ਨਹੀਂ ਨਹੀਂ ਜੀ ਹੈ ਬ ਬੱਚਿਆਂ ਦੇ ਆਲ ਟਾਈਪ ਸਾ ਸਾਈਜ਼ ਹੈਗੇ ਆਪਣੇ ਕੋਲ ਅਤੇ ਪੂਰੀ ਫੁੱਲ ਫੈਮਲੀ ਦੀ ਮਿਲ ਜਾਣਗੇ ਤੁਹਾਨੂੰ ਇੱਦਾਂ ਦਾ ਕੋਈ ਹੈ ਨਹੀਂ ਚੱਕਰ ਨਹੀਂ ਗਾ ਵਿਜ਼ਿਟ ਕਰੋ ਤੁਸੀਂ ਹਾਂ ਹਾਂ ਵਾਧੂ ਜੀ ਸਾਈਜ਼ਾ ਦੀ ਤਾਂ ਕੋਈ ਕਮੀ ਨਹੀਂ ਕੋਈ ਨਹੀਂ ਤੁਸੀ ਵਿਜ਼ਿਟ ਕਰੋ ਜੀ ਇੱਕ ਵਾਰੀ ਆ ਕੇ ਹਾਂਜੀ ਹਾਂਜੀ ਵਾਧੂ ਹੈ ਬੱਚਿਆਂ ਦੇ ਵਾਸਤੇ ਤਾਂ ਬਹੁਤ ਸਾਰੀਆਂ ਆਈਟਮ ਹੈਗੀਆਂ ਫ਼ੋਨ 'ਤੇ ਤਾਂ ਆਪਾਂ ਤੋਂ ਡਿਸਕਸ ਨਹੀਂ ਹੋਣੀਆਂ ਇੱਕ ਵਾਰੀ ਤੁਸੀਂ ਸਟੋਰ 'ਤੇ ਆ ਵਿਜ਼ਿਟ ਜ਼ਰੂਰ ਕਰੋ ਤੁਹਾਨੂੰ ਫਿਰ ਪਤਾ ਲੱਗਣਾ ਵੀ ਤੁਸੀਂ ਤਾਂ ਥੈਲੇ ਭਰ ਭਰ ਕੇ ਲੈ ਕੇ ਜਾਉਂਗੇ ਜੀ ਹਾਂਜੀ ਹਾਂਜੀ ਉਹਦੇ ਵਾਸਤੇ ਦੇਖੋ ਜੀ ਕੰਪਨੀ ਵੱਲੋਂ ਤਾਂ ਕੋਈ ਡਿਸਕਾਊਂਟ ਹੈ ਨਹੀਂ ਗਾ ਅਸੀਂ ਆਪਣੇ ਸਟੋਰ ਵੱਲੋਂ ਤੁਹਾਨੂੰ ਕੋਈ ਗਿਫਟ ਦੇ ਸਕਦੇ ਹੈਗੇ ਜੇ ਵੀ ਤੁਸੀਂ ਦਸ ਹਜ਼ਾਰ ਤੋਂ ਵੱਧ ਤੁਹਾਡੀ ਸ਼ੋਪਿੰਗ ਹੁੰਦੀ ਹੈ ਤਾਂ ਹਾਂ ਹਾਂਜੀ ਹਾਂਜੀ ਟੋਟਲ ਤੁਹਾਡਾ ਜਿਹਨੂੰ ਐਡ ਕਰ ਲਵਾਂਗੇ ਦਸ ਹਜ਼ਾਰ ਤੋਂ ਉੱਪਰ ਜਾਂਦਾ ਤਾਂ ਅਸੀਂ ਆਪਣੇ ਸਟੋਰ ਵੱਲੋਂ ਤੁਹਾਨੂੰ ਇੱਕ ਵਧੀਆ ਗਿਫਟ ਹੈਮਪਰ ਦੇਵਾਂਗੇ ਨਹੀਂ ਨਹੀਂ ਹਾਂ ਲੇਡਿਜ ਦਾ ਸਟੋਕ ਫੁੱਲ ਹੈ ਜੀ ਹਾਊਸਵਾਈਫ ਦੇ ਲਈ ਹੈਗਾ ਔੱਫਿਸ ਜਾਣ ਵਾਲੀਆਂ ਅ ਲੜਕੀਆਂ ਬਹੁਤ ਆਉਂਦੀਆਂ ਸਾਡੇ ਕੋਲ ਜਿੰਨੀਆਂ ਜੋਬ ਕਰਦੀਆਂ ਲੜਕੀਆਂ ਸਾਰੀਆਂ ਇੱਥੋਂ ਹੀ ਲੈ ਕੇ ਜਾਂਦੀਆਂ ਜੀ ਹਾਂਜੀ ਹਾਂਜੀ ਸਾਰੇ ਸਾਇਜ਼ ਅਵੇਲੇਬਲ ਹੈ ਜੀ ਆਪਣੇ ਕੋਲ ਇਹ ਆਪਣਾ ਪੈਂਦੀ ਹੈ ਜੀ ਇਕ ਜਦੋਂ ਤੁਸੀਂ ਬੱਸ ਸਟੈਂਡ ਤੋਂ ਇੱਧਰ ਨੂੰ ਜਾਓਗੇ ਸਟੇਸ਼ਨ ਹਾਂ ਹਾਂ ਬਿਲਕੁਲ ਰਾਇਟ ਸਟੇਸ਼ਨ ਵੱਲ ਜਾਓਗੇ ਨਾ ਤਾਂ ਰਾਈਟ ਹੈਂਡ ਹੈਗੀ ਉਦੋਂ ਕਿਸੇ ਮਰਜ਼ੀ ਪੁੱਛ ਲਿਓ ਜੀ ਸ਼ਰਮਾ ਸ਼ੂ ਹਾਊਸ ਬਰਨਾਲਾ ਤੁਸੀਂ ਮੈਨੂੰ ਇੱਧਰ ਇੰਸਟਾਗ੍ਰਾਮ ਤੋਂ ਵੀ ਮੈਨੂੰ ਫਾਈ ਅ ਸਰਚ ਕਰ ਲਓ ਉਹਦੇ ਨਾਲ ਤੁਸੀਂ ਈਜ਼ੀਲੀ ਸਾਡਾ ਜਿਹੜਾ ਆਪਣਾ ਦੁਕਾਨ ਦਾ ਇੰਸਟਾਗ੍ਰਾਮ ਚੈਨਲ ਚੱਲਦਾ ਸਾਡਾ ਉਹਦੇ ਉੱਪਰ ਤੁਹਾਨੂੰ ਸਾਰੀ ਅ ਜੋ ਅਸੀਂ ਪਾਇਆ ਵਿਆ ਨਾ ਇਹਦੇ ਇੰਸਟਾਗ੍ਰਾਮ ਆਈ ਡੀ 'ਤੇ ਸਾਡੀ ਸਾਰੇ ਸਾਈਜ਼ ਵਗੈਰਾ ਜੋ ਵੀ ਕੋਈ ਸਾਡੇ ਕੋਲ ਹੈਗਾ ਗਾ ਅਵੇਲੇਬਲ ਆ ਤੁਸੀਂ ਉੱਥੋਂ ਚੂਜ ਕਰਕੇ ਵੀ ਸਾਡੇ ਕੋਲ ਆ ਸਕਦੇ ਨੇ ਇਹੀ ਹੈ ਜੀ ਸ਼ਰਮਾ ਸ਼ੂ ਹਾਊਸ ਬਰਨਾਲਾ ਹਾਂਜੀ ਹਾਂਜੀ ਹਾਂ ਹਾਂ ਜ਼ਰੂਰ ਜੀ ਮੋਸਟ ਵੈਲਕਮ ਬਾਈ ਜੀ ਓਕੇ ਓਕੇ ਓਕੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ